ਪੰ ਪੰਜਾਬ ਦਾ ਸੱਭਿਆਚਾਰ ਭਾਰਤ ਦੇ ਦੂਜੇ ਰਾਜਾਂ ਨਾਲੋਂ ਬਹੁਤ ਵਧੀਆ ਹੈ ਇੱਥੇ ਦਾ ਸੱਭਿਆਚਾਰ ਰਹਿਣ ਸਹਿਣ ਖਾਣ ਪੀਣ ਬਹੁਤ ਵਧੀਆ ਹੈ ਅਤੇ ਲੋਕ ਇੱਥੇ ਨਾ ਨੱਚ ਨੱਚ ਗਾ ਕੇ ਗਿੱਧਾ ਪਾ ਕੇ ਆਪਣਾ ਪ੍ਰਗਟਾਵਾ ਕਰਦੇ ਹਨ ਅਤੇ ਇਸ ਲਈ ਪੰਜਾਬ ਦਾ ਸੱਭਿਆਚਾਰ ਬਹੁਤ ਜ਼ਿਆਦਾ